ਮੇਰਾ ਨਾਮ ਪ੍ਰਭਜੋਤ ਹੈ ਤੇ ਮੈਂ ਦਸ ਕੁ ਦਿਨਾਂ ਤੱਕ ਗਰਮੀ ਦੀ ਛੁੱਟੀਆਂ ਚ ਰਿਮੋਟ ਕੈਬਿਨ ਜਾਣਾ ਚਾਹੁੰਦੀ ਆਂ ਤੇ ਉੱਥੇ ਸੂਤਰਾ ਦੇ ਹਵਾ ਹਵਾਲੇ ਮੈਨੂੰ ਪਤਾ ਲੱਗਿਆ ਹੈ ਕਿ ਉੱਥੇ ਪਾਣੀ ਦੀ ਭਾਰੀ ਕਮੀ ਹੈ ਜਿਹਦੇ ਕਰਕੇ ਮੈਂ ਤੁਹਾਨੂੰ ਇੱਕ ਟੈਂਕ ਇੱਕ ਟੈਂਕਰ ਮੰਗਵਾਉਣ ਲਈ ਕਹਿਣਾ ਚਾਹੁੰਦੀ ਹਾਂ ਕਿ ਉੱਥੇ ਪਲੀਜ਼ ਟੈਂਕਰ ਦਾ ਪ੍ਰਬੰਧ ਕਰ ਦੋ ਤਾਂ ਕਿ ਉੱਥੇ ਸਾਫ ਪਾਣੀ ਨਹਾਣ ਲਈ ਅਤੇ ਪੀਣ ਜੋਗਾ ਹੋਵੇ ਤਾਂ ਕਿ ਮੈਂ ਆਪਣੀ ਗਰਮੀ ਦੀ ਛੁੱਟੀਆਂ ਸਹੀ ਸਲਾਮਤ ਕੱਟ ਪਾਵਾਂ ਤੇ ਮੇਰਾ ਫੋਨ ਨੰਬਰ ਸੱਤ ਜੀਰੋ ਅੱਠ ਸੱਤ ਦੋ ਇੱਕ ਚਾਰ ਤਿੰਨ ਦੋ ਸੱਤ ਹੈ ਪਲੀਜ ਮੈਨੂੰ ਕਾਲ ਕਰਨਾ